ਮੈਂ ਸਿਮਰਨ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਜਿੱਦਾਂ ਕਿ ਤੁਸੀਂ ਪੁੱਛਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਤੁਹਾਡੇ ਉਦਯੋਗ 'ਚ ਕਿਹੜੀਆਂ ਤਕਨੀਕੀ ਕਾਢਾਂ ਦਾ ਸਭ ਤੋਂ ਵੱਡਾ ਪ੍ਰਭਾਵ ਪਏਗਾ ਅ ਨਿਊ ਅਨਰਜੀ ਜਿੱਦਾਂ ਕਿ ਅਨਰਜੀ ਅੱਜ ਕੱਲ੍ਹ ਕਾਫੀ ਫਰਕ ਪੈ ਗਿਆ ਆ ਇੰਡੀਆ ਦੇ ਵਿੱਚ ਜਾਂ ਪੂਰੇ ਵਰਡ 'ਚ ਲਾ ਲਓ ਕਿ ਪਹਿਲੇ ਪੈਟਰੋਲ 'ਤੇ ਸੀਗੀਆਂ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਬੈਟਰੀ 'ਤੇ ਹੋ ਗਈਆਂ ਨੇ ਅਤੇ ਸਕੂਟਰੀਆਂ ਵੀ ਚੱਲ ਪਈਆਂ ਨੇ ਬੈਟਰੀ ਵਾਲੇ ਈ ਰਕਸ਼ਾ ਵੀ ਚੱਲ ਪਏ ਨੇ ਆਉਣ ਵਾਲੇ ਸਮੇਂ 'ਚ ਬੈਟਰੀ ਵਾਲੀਆਂ ਗੱਡੀਆਂ ਵੀ ਚੱਲ ਪੈਣੀਆਂ ਨੇ ਸੋ ਕਾਫੀ ਮਤਲਬ ਚੇਂਜ ਆ ਰਹੇ ਨੇ ਅਤੇ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਇਹਨਾਂ ਦੀਆਂ ਹੋਰ ਸੁਵਿਧਾਵਾਂ ਹੋ ਜਾਣਗੀਆਂ ਕਿ ਜਿੱਦਾਂ ਪੈਟਰੋਲ ਦਾ ਰੇਟ ਵੀ ਵੱਧ ਰਿਹਾ ਇੱਥੇ ਲੋਕ ਬੈਟਰੀ ਵਾਲੇ ਰਿਕਸ਼ੇ ਬੈਟਰੀ ਵਾਲੀਆਂ ਸਕੂਟਰੀਆਂ ਆ ਲੈ ਰਹੇ ਨੇ ਜਿਹਨਾਂ ਨੂੰ ਕਿ ਚਾਰਜ ਕਰੋ ਅਤੇ ਆਪਣਾ ਉਸ ਦੀ ਵਰਤੋਂ ਕਰੋ ਸੋ ਆਉਣ ਵਾਲੇ ਸਮੇਂ 'ਚ ਕਾਫੀ ਤਕਨੀਕ ਦੇ ਵਿੱਚ ਚੇਂਜ ਆਏਗਾ ਐਨਰਜੀ ਦੇ ਵਿੱਚ ਜਿੱਦਾਂ ਸੋਲਰ ਸਿਸਟਮ ਲੋਕਾਂ ਨੇ ਲਾਏ ਨੇ ਅੱਜ ਕੱਲ੍ਹ ਜਿਸ ਨਾਲ ਲਾਈਟ ਦੀ ਵੀ ਬੱਚਤ ਹੁੰਦੀ ਹੈ ਜਿਹਨੂੰ ਕਿ ਸੂਰਜ ਦੀ ਰੌਸ਼ਨੀ ਤੋਂ ਸਾਨੂੰ ਲਾਈਟ ਪ੍ਰਾਪਤ ਹੁੰਦੀ ਹੈ ਜੋ ਕਿ ਇੱਕ ਕੁਦਰਤੀ ਤਕਨੀਕ ਹੈ ਅਤੇ ਲੋਕਾਂ ਨੇ ਕਾਫੀ ਲੋਕਾਂ ਨੇ ਘਰਾਂ ਵਿੱਚ ਸੋਲਰ ਸਿਸਟਮ ਲਗਾਏ ਨੇ ਅਤੇ ਜਿੱਦਾਂ ਕਿ ਉਹਦੇ ਨਾਲ ਸਾਨੂੰ ਲਾਈਟ ਪ੍ਰਾਪਤ ਹੁੰਦੀ ਹੈ ਅਤੇ ਇਸ ਤਰ੍ਹਾਂ ਹੀ ਜਿੱਦਾਂ ਤੁਸੀਂ ਕਹਿ ਰਹੇ ਹਾਂ ਕਿ ਆਪਣਾ ਡਿਜ਼ੀਟਲ ਟਰਸਟ ਕਰ ਸਕਦੇ ਹਾਂ ਬਿਲਕੁਲ ਕਰ ਸਕਦੇ ਹਾਂ ਡਿਜੀਟਲ ਟਰਸਟ ਕਿਉਂ ਨਹੀਂ ਕਰ ਸਕਦੇ ਅੱਜ ਕੱਲ੍ਹ ਸਾਰਾ ਸਿਸਟਮ ਹੀ ਆਨਲਾਈਨ ਹੋ ਗਿਆ ਆ ਆਪਣਾ ਇੰਡੀਆ ਵੀ ਡਿਡੀ ਡਿਜ਼ੀਟਲ ਹੋ ਗਿਆ ਆ ਜਿਸ ਕਾਰਨ ਲੋਕਾਂ ਦਾ ਟਾਈਮ ਦੀ ਵੀ ਬੱਚਤ ਹੁੰਦੀ ਆ ਪਹਿਲੇ ਲੋਕਾਂ ਨੂੰ ਕੋਈ ਕੰਮ ਕਰਵਾਉਣਾ ਪੈਂਦਾ ਸੀ ਬੈਂਕਾਂ 'ਚ ਕਿੰਨੇ ਕਿੰਨੇ ਚੱਕਰ ਲਾਉਣੇ ਪੈਂਦੇ ਸੀ ਸਕੂਲਾਂ 'ਚ ਲਾਉਣੇ ਪੈਂਦੇ ਸੀ ਅੱਜ ਕੱਲ੍ਹ ਸਾਰਾ ਡਿਜੀਟਲ ਹੋ ਗਿਆ ਆ ਘਰ ਬੈਠੇ ਤੁਸੀਂ ਇਹਨਾਂ ਚੀਜ਼ਾਂ ਦਾ ਫਾਇਦਾ ਚੱਕ ਸਕਦੇ ਆਂ ਆਨਲਾਈਨ ਆਪਣੀਆਂ ਫੀਸਾਂ ਪੇ ਕਰਕੇ ਆਨਲਾਈਨ ਬੈਂਕਾਂ ਦੀ ਸਰਵਿਸ ਲੈ ਕੇ ਤੁਸੀਂ ਇਹਨਾਂ ਚੀਜ਼ਾਂ ਦਾ ਲਾਭ ਚੱਕ ਸਕਦੇ ਹਾਂ ਡਿਜੀਟਲ ਦਾ ਤੋਂ ਸੋ ਇਹਨਾਂ 'ਤੇ ਅਸੀਂ ਵਿਸ਼ਵਾਸ ਵੀ ਕਰ ਸਕਦੇ ਹਾਂ ਕੋਈ ਇਹੋ ਜਿਹੀ ਗੱਲ ਵੀ ਨਹੀਂ ਆ ਅਤੇ ਕਿਉਂਕਿ ਸਾਰਾ ਡਾਟਾ ਤੁਹਾਡਾ ਆਨਲਾਈਨ ਹੁੰਦਾ ਆ ਅਤੇ ਤੁਸੀਂ ਜਿਸ ਟਾਈਮ ਮਰਜ਼ੀ ਉਹਨੂੰ ਤੁਸੀਂ ਆਪਣਾ ਨੈੱਟ 'ਤੇ ਪਾਓ ਅਤੇ ਚੈੱਕ ਕਰ ਸਕਦੇ ਹਾਂ ਅਤੇ ਆਪਣੇ ਟਾਈਮ ਦੀ ਬੱਚਤ ਹੁੰਦੀ ਹੈ ਕਿਉਂਕਿ ਅੱਜ ਕੱਲ੍ਹ ਲੋਕਾਂ ਕੋਲ ਟਾਈਮ ਬਹੁਤ ਘੱਟ ਹੈ ਜਿੱਦਾਂ ਕਿ ਲੋਕਡਾਊਨ ਲੱਗਣ ਤੋਂ ਬਗੈ ਬਾਅਦ ਆਪਣੇ ਇੰਡੀਆ 'ਚ ਵੀ ਸਾਰਾ ਸਿਸਟਮ ਆਨਲਾਈਨ ਹੋ ਗਿਆ ਹੈ ਇੰਡੀਆ ਡਿਜੀਟਲ ਹੋ ਗਿਆ ਹੈ ਸੋ ਇਸ ਚੀਜ਼ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਆ ਅਤੇ ਆਉਣ ਵਾਲੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਕਨੀਕ ਤਬਦੀਲੀਆਂ ਆਉਣਗੀਆਂ ਜਿਹਨਾਂ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਲਾਭ ਹੋਏਗਾ ਜਿਹਦੇ ਕਾਰਨ ਲੋਕਾਂ ਨੂੰ ਸੁੱਖ ਸੁਵਿਧਾ ਜ਼ਿਆਦਾ ਹੋ ਜਾਣਗੇ